ਸੈਰ ਸਪਾਟਾ ਕਰਨ ਆਏ ਸੈਲਾਨੀਆਂ ਦਾ ਧਿਆਨ ਖਿੱਚਣ ਲਈ ਪੰਜਾਬੀ ਰੰਗ ਵਿੱਚ ਰੰਗੀਆਂ ਫੁਲਕਾਰੀਆਂ ਪਰਾਂਦੀਆਂ ਨਾਲ਼ੇ ਪੰਜਾਬੀ ਜੁੱਤੀਆਂ ਦੀਆਂ ਸਟਾਲਾਂ ਸੈਰ ਸਪਾਟਾ ਕੇਂਦਰਾਂ ਦੇ ਨੇੜੇ ਲਾਈਆਂ ਜਾਂਦੀਆਂ ਨੇ ਜਿਹਨਾਂ ਨਾਲ ਪੰਜਾਬੀ ਘਰੇਲੂ ਉਦਯੋਗ ਦੀ ਕਲਾ ਲੋਕਾਂ ਦੇ ਸਾਹਮਣੇ ਆਉਂਦੀ ਹੈ ਅਤੇ ਸਾਨੂੰ ਘਰੇਲੂ ਉਦਯੋਗਾਂ ਤੋਂ ਮਾਲੀ ਸਹਾਇਤਾ ਵੀ ਮਿਲਦੀ ਹੈ